ਮੈਨੂੰ ਸਮਕਾਲੀ ਸੰਗੀਤ ਗਾਉਣਾ ਵਧੀਆ ਲੱਗਦਾ ਹੈ ਕਿਉਂਕਿ ਇਹ ਅੱਜ ਦੇ ਸਮੇਂ ਦੇ ਹਿਸਾਬ ਨਾਲ ਬਹੁਤ ਹੀ ਵਿਭਿੰਨ ਸ਼ੈਲੀਆਂ ਵਿੱਚ ਉਪਲਬੱਧ ਹੈਗਾ ਵਾ ਇਸ ਵਿੱਚ ਪੱਛਮੀ ਅਤੇ ਭਾਰਤੀ ਦੋਵੇਂ ਤਰ੍ਹਾਂ ਦੇ ਤੱਤ ਸ਼ਾਮਿਲ ਹੋ ਸਕਦੇ ਆ ਜਿਸ ਕਰ ਕਾਰਨ ਇਹ ਹੋਰ ਵੀ ਦਿਲਚਸਪ ਬਣ ਜਾਂਦਾ ਵਾ ਇਸ ਤੋਂ ਇਲਾਵਾ ਸਮਕਾਲੀ ਸੰਗੀਤ ਗਾਉਣਾ ਮੇਰੀ ਆਵਾਜ਼ 'ਤੇ ਥੋੜ੍ਹਾ ਅਸਾਨ ਹੈਗਾ ਵਾ ਕਿਉਂਕਿ ਇਸ ਵਿੱਚ ਸਖ਼ਤ ਤਕਨੀਕੀ ਨਿਯਮ ਨਹੀਂ ਹਨ ਅਤੇ ਇਮੋਸ਼ਨ ਅਤੇ ਐਕਸਪ੍ਰੈਸ਼ਨ ਨੂੰ ਵ ਵਧੇਰਾ ਮਤਲਬ ਮਹੱਤਵ ਮਿਲਦਾ ਹੈ ਇਸ ਤਰ੍ਹਾਂ ਦੀ ਗਾਉਣ ਵਿੱਚ ਸ਼ਾਸਤਰੀ ਸੰਗੀਤ ਦੂਜੇ ਪਾਸੇ ਬਹੁਤ ਗਹਿਰਾ ਅਤੇ ਸੁੰਦਰ ਹੁੰਦਾ ਹੈ ਇਸ ਨੂੰ ਸਿੱਖਣ ਲਈ ਕਈ ਸਾਲਾਂ ਦੀ ਮਿਹਨਤ ਸਬਰ ਅਤੇ ਉੱਚੀ ਤਕਨੀਕੀ ਸਮਝ ਦੀ ਲੋੜ ਪੈਂਦੀ ਹੈ ਰਾਗਾਂ ਸੁਰਾਂ ਲੈਅ ਅਤੇ ਤਾਲਾਂ ਦੀ ਥੋੜ੍ਹੀ ਵੀ ਗਲਤੀ ਗਾਣੇ 'ਤੇ ਪ੍ਰਭਾਵ ਨੂੰ ਬਦਲ ਸਕਦੀ ਹੈ ਜਿਸ ਕਾਰਨ ਇਹ ਕਾਫ਼ੀ ਮੁਸ਼ਕਲ ਹੋ ਜਾਂਦਾ ਹੈ ਹਾਲਾਂਕਿ ਜੇਕਰ ਕਿਸੇ ਕੋਲ ਧੀਰਜ ਅਤੇ ਅਭਿਆਸ ਹੋਵੇ ਤਾਂ ਸ਼ਾਸਤਰੀ ਸੰਗੀਤ ਗਾਉਣਾ ਬਹੁਤ ਹੀ ਸੰਤੋਸ਼ਦਾਇਕ ਅਤੇ ਆਤਮਿਕ ਤੌਰ 'ਤੇ ਸੁੱਖਦ ਅਨੁਭਵ ਹੋ ਸਕਦਾ ਹੈ ਆਖਿਰਕਾਰ ਇਹ ਨਿੱਜੀ ਪਸੰਦ 'ਤੇ ਨਿਰਭਰ ਕਰਦਾ ਹੈ ਜਦੋਂ ਵੀ ਮੈਨੂੰ ਆਜ਼ਾਦੀ ਦਾ ਨਾਲ ਗਾਉਣ ਦਾ ਮਨ ਕਰਦਾ ਹੈ ਤਾਂ ਮੈਂ ਸਮਕਾਲੀ ਸੰਗੀਤ ਨੂੰ ਤਰਜੀਹ ਦਿੰਦਾ ਹਾਂ ਪਰ ਸ਼ਾਸਤਰੀ ਸੰਗੀਤ ਦੀ ਗੁੰਝਲਦਾਰਤਾ ਮਤਲਬ ਉਹਦਾ ਔਖਾਪਨ ਅਤੇ ਸੁੰਦਰਤਾ ਵੀ ਕਦਰ ਕਰਦਾ ਹਾਂ ਅਤੇ ਉਸ ਨੂੰ ਵੀ ਮੈਂ ਆਪਣੀ ਪ੍ਰੈਕਟਿਸ ਦੇ ਵਿੱਚ ਸ਼ਾਮਿਲ ਕਰਦਾ ਹਾਂ ਅਤੇ ਦੋਵੇਂ ਸਿੱਖਣ ਦੀ ਮੈਂ ਪੂਰੀ ਕੋਸ਼ਿਸ਼ ਕਰਦਾ ਹਾਂ ਕਲਾਸਿਸ ਵੀ ਲਗਾਉਂਦਾ ਹਾਂ ਉਹਨਾਂ ਦੀਆਂ